ਹਾਂਜੀ ਅਸੀਂ ਤਿੰਨ ਭਰਾ ਹਾਂ ਮੈਂ ਸਾਰਿਆਂ ਤੋਂ ਵੱਡਾ ਹਾਂ ਅਤੇ ਦੋ ਮੇਰੇ ਤੋਂ ਛੋਟੇ ਹਨ ਜਾਣੀ ਕਿ ਮੈਂ ਪਹਿਲਾਂ ਸ਼ੁਰੂਆਤ ਮੈਂ ਆਪਣੇ ਤੋਂ ਕਰਦਾ ਹਾਂ ਮੇਰਾ ਮੈਂ ਨੌਕਰੀ ਪੇਸ਼ਾ ਕਰਦਾ ਹਾਂ ਅਤੇ ਸ ਆਪਣਾ ਅਲੱਗ ਉਹਦੇ ਵਿੱਚ ਰਹਿੰਦਾ ਪਲਾਟ ਦੇ ਵਿੱਚ ਰਹਿੰਦਾ ਹਾਂ ਅਤੇ ਜਿਹੜਾ ਮੇਰਾ ਦੂਜਾ ਭਰਾ ਹੈ ਉਹ ਉਸ ਦਾ ਧਿਆਨ ਖੇਤੀ ਵੱਲ ਜ਼ਿਆਦਾ ਹੈ ਉਹਨੂੰ ਖੇਤੀ ਦੇ ਨਵੀਂ ਨਵੀਂ ਟੈਕਨੋਲਜੀ ਨਵੇਂ ਨਵੇਂ ਸਬਜ਼ੀਆਂ ਉਗਾਉਣ ਦੀਆਂ ਬਹੁਤ ਜ਼ਿਆਦਾ ਤਮੰਨਾ ਰਹਿੰਦੀ ਹੈ ਪਰ ਜਿਹੜਾ ਮੇਰਾ ਤੀਜਾ ਭਰਾ ਹੈ ਉਹ ਹਲੇ ਪੜ੍ਹ ਰਿਹਾ ਹੈ ਉਹ ਬਹੁਤ ਜ਼ਿਆਦਾ ਸ਼ਰਾਰਤੀ ਹੈ ਔਰ ਸਾਡੇ ਸਾਰੇ ਪਰਿਵਾਰ ਦਾ ਉਹ ਇੱਕ ਲਾਡਲਾ ਬੱਚਾ ਮੰਨਦੇ ਅਸੀਂ ਉਹਨੂੰ ਔਰ ਜਦੋਂ ਵੀ ਉਸਨੇ ਪੈਸੇ ਲੈਣੇ ਹੁੰਦੇ ਹਨ ਕਦੇ ਤਾਂ ਮੇਰੇ ਕੋਲ ਆ ਜਾਂਦਾ ਬਹਾਨਾ ਮਾਰ ਕੇ ਪਤਾ ਮੈਨੂੰ ਵੀ ਹੁੰਦਾ ਹੈ ਵੀ ਬਹਾਨਾ ਮਾਰ ਕੇ ਪੈਸੇ ਲੈ ਰਿਹਾ ਕਦੇ ਦੂਜੇ ਭਰਾ ਕੋਲੋਂ ਜੋ ਸਬਜ਼ੀਆਂ ਖੇਤੀ ਦਾ ਕੰਮ ਕਰਦਾ ਹੈ ਉਸ ਤੋਂ ਪੈਸਾ ਲੈ ਜਾਂਦਾ ਹੈ ਔਰ ਫਜ਼ੂਲ ਖਰਚੀ ਚਲੋ ਛੋਟਾ ਹੋਣ ਕਰਕੇ ਉਹਨੂੰ ਆਦਤ ਪੈ ਚੁੱਕੀ ਹੈ ਫਿਰ ਵੀ ਉਹਦਾ ਪੜ੍ਹਾਈ ਵੱਲ ਬਹੁਤ ਜ਼ਿਆਦਾ ਧਿਆਨ ਹੈ ਔਰ ਮੇਰਾ ਜਿਹੜਾ ਖੇਤੀ ਕਰਦਾ ਭਰਾ ਹੈ ਉਸ ਨੂੰ ਸੰਦਾਂ ਵੱਲ ਆਪਣਾ ਜਿਵੇਂ ਨਵਾਂ ਨਵਾਂ ਟਰੈਕਟਰ ਲੈ ਕੇ ਆਉਣਾ ਨਵੀਂ ਟਰਾਲੀ ਲੈ ਕੇ ਆਉਣੀ ਨਵੇਂ ਹਲ ਲੈ ਕੇ ਆਉਣੇ ਇਹ ਚੀਜ਼ਾਂ ਵੱਲ ਉਸਦਾ ਜ਼ਿਆਦਾ ਧਿਆਨ ਹੈ ਪਰ ਉਹ ਸੰਦਾਂ ਦੀ ਖਿਆਲ ਵੀ ਐਨਾ ਰੱਖਦਾ ਅਗਰ ਕਦੇ ਮੈਂ ਜਦੋਂ ਪਿੰਡ ਜਾਂਦਾ ਹਾਂ ਜਾਂ ਮੈਂ ਉਸਨੂੰ ਚਲਾਉਣ ਨੂੰ ਵੀ ਕਹਿ ਦੇਵਾਂ ਵੀ ਮੈਂ ਚਲਾਉਂਗਾ ਉਹ ਹਰ ਵਕਤ ਮੈਨੂੰ ਦੇਖਦਾ ਰਹਿੰਦਾ ਹੈ ਕਿਤੇ ਗਲਤ ਨਾ ਚਲਾਉਂਦਾ ਹੋਵੇ ਵੀ ਕਿਤੇ ਕਿਸੇ ਚੀਜ਼ 'ਚ ਮਾਰੇ ਨਾ ਕਿਉਂਕਿ ਮੇਰਾ ਇਹ ਸ ਸੰਦਾਂ ਵੱਲ ਚਲਾਉਣ ਨੂੰ ਹਾਲੇ ਤਜ਼ਰਬਾ ਘੱਟ ਘੱਟ ਲੈ ਲਉ ਕਹਿ ਲਉ ਜਾਂ ਮੈਨੂੰ ਹਾਲੇ ਇਸ ਦੀ ਨੌਲੇਜ ਘਾਟ ਆ ਉਹ ਮੇਰਾ ਵੀ ਪੂਰਾ ਖਿਆਲ ਰੱਖਦਾ ਹੈ